ਸਤਿ ਸ਼੍ਰੀ ਅਕਾਲ ਜੀ ਜੀ ਹਾਂ ਮੈਂ ਕਿਸੇ ਨੂੰ ਪੇਂਟਿੰਗ ਦਾ ਤੋਹਫ਼ਾ ਦਿੱਤਾ ਸੀ ਜੋ ਕਿ ਮੈਂ ਆਪਣੇ ਹੱਥਾਂ ਨਾਲ ਬਣਾਈ ਸੀ ਉਹ ਪੇਂਟਿੰਗ ਵਿੱਚ ਮੈਂ ਆਪਣੇ ਭੈਣ ਦੀ ਤਸਵੀਰ ਬਣਾਈ ਸੀ ਉਸ ਵੇਲੇ ਮੈਨੂੰ ਪੂਰੀ ਤਰੀਕੇ ਯਾਦ ਹੈ ਉਸ ਦਾ ਜਨਮਦਿਨ ਸੀ ਅਤੇ ਮੈਂ ਉਸ ਨੂੰ ਤੋਹਫ਼ੇ ਵਜੋਂ ਉਸ ਦੀ ਤਸਵੀਰ ਬਣਾ ਕੇ ਦਿੱਤੀ ਸੀ ਅਤੇ ਜਦੋਂ ਉਸ ਨੇ ਉਹ ਤਸਵੀਰ ਦੇਖੀ ਤਾਂ ਉਹ ਬੜਾ ਹੀ ਸ਼ੋਕ ਅਤੇ ਬੜਾ ਹੀ ਖੁਸ਼ ਹੋਈ ਅਤੇ ਉਸ ਨੇ ਉਸ ਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਵੋ ਉਹ ਤਸਵੀਰ ਬੜੀ ਹੀ ਜ਼ਿਆਦਾ ਪਸੰਦ ਆਈ ਸੀ ਉਸ ਨੇ ਆਪਣੇ ਭਾਵ ਖੁਸ਼ੀ ਵਾਲੇ ਬੜੇ ਹੀ ਵਧੀਆ ਤਰੀਕੇ ਨਾਲ ਪ੍ਰਗਟ ਕੀਤੇ ਅਤੇ ਉਹਨੂੰ ਮੇਰੀ ਤਸਵੀਰ ਬੜੀ ਹੀ ਜ਼ਿਆਦਾ ਸੋਹਣੀ ਲੱਗੀ ਅਤੇ ਜਦੋਂ ਮੈਂ ਉਸ ਨੂੰ ਇਹ ਤਸਵੀਰ ਸਾਰਿਆਂ ਦੇ ਸਾਹਮਣੇ ਦਿੱਤੀ ਤਾਂ ਉਸ ਨੇ ਖੋਲ੍ਹ ਕੇ ਦੇਖੀ ਤਾਂ ਸਭ ਨੂੰ ਮੇਰੇ ਇਹ ਹੁਣ ਨਰਬਾਰੇ ਵਿੱਚ ਵੀ ਪਤਾ ਲੱਗਾ ਅਤੇ ਮੈਂ ਮੇਰੇ ਮਾਂ ਬਾਪ ਨੂੰ ਵੀ ਮੇਰੇ 'ਤੇ ਬੜਾ ਮਾਣ ਮਹਿਸੂਸ ਹੋਇਆ ਅਤੇ ਉਹ ਮੇਰਾ ਆਪਣੀ ਭੈਣ ਦੇ ਪ੍ਰਤੀ ਪਿਆਰ ਦੇਖ ਕੇ ਬੜਾ ਹੀ ਖੁਸ਼ ਹੋਏ ਹੱਥ ਨਾਲ ਬਣੀਆਂ ਚੀਜ਼ਾਂ ਦਾ ਜ਼ਿਆਦਾ ਭਾਵਨਾਤਮਕ ਮੁੱਲ ਇਸ ਕਰਕੇ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਹੱਥ ਨਾਲ ਬਣਾਉਂਦੇ ਹਾਂ ਤਾਂ ਅਸੀਂ ਉਸ ਵਿੱਚ ਜਿੱਦਾਂ ਮਰਜੀ ਆਪਣੇ ਮਨ ਦੇ ਭਾਵ ਪ੍ਰਗਟ ਕਰ ਸਕਦੇ ਹਾਂ ਪਰ ਜਿਹੜੀ ਮਸ਼ੀਨਾਂ ਰਾਹੀਂ ਤਸਵੀਰ ਛਾਪ ਛਪ ਹੀ ਜਾਂਦੀ ਹੈ ਉਸ ਨੂੰ ਆਪਾਂ ਕੋਈ ਵੀ ਭਾਵ ਪ੍ਰਗਟ ਕਰਕੇ ਨਹੀਂ ਦਿਖਾ ਸਕਦੇ ਇਸ ਕਰਕੇ ਹੱਥਾਂ ਨਾਲ ਬਣਾਈ ਹੋਈ ਚੀਜ਼ ਦਾ ਚਲਣ ਦਾ ਸਮਾਂ ਵੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਮੇਰਾ ਵੀ ਇਹੀ ਓ ਮੰਨਣਾ ਹੈ ਕਿ ਸਾਨੂੰ ਹੱਥ ਨਾਲ ਬਣਾਈ ਚੀਜ਼ਾਂ ਨੂੰ ਅੱਗੇ ਰੱਖਣਾ ਚਾਹੀਦਾ ਹੈ ਕਿ ਮਸ਼ੀਨੀ ਛਾਪੀਆਂ ਹੋਈਆਂ ਤਸਵੀਰਾਂ ਨੂੰ ਧੰਨਵਾਦ ਜੀ